ਪਹਾੜ 'ਤੇ ਠੰਢੀਆਂ ਹਵਾਵਾਂ ਤੋਂ ਬਚਣ ਲਈ ਸਾਨੂੰ ਕਾਫੀ ਸਾਰੀਆਂ ਚੀਜ਼ਾਂ ਲੈ ਕੇ ਜਾਣੀਆਂ ਚਾਹੀਦੀਆਂ ਜਿਵੇਂ ਮੋਟੇ ਕੱਪੜੇ ਪਾ ਕੇ ਜਾਣੇ ਚਾਹੀਦੇ ਦਸਤਾਨੇ ਪਾ ਕੇ ਜਾਣੇ ਚਾਹੀਦੇ ਹਨ ਜਰਾਬਾਂ ਮੋਟੀਆਂ ਜਰਾਬਾਂ ਪਾਉਣੀਆ ਚਾਹੀਦੀਆਂ ਹਨ ਟੋਪੀ ਗਰਮ ਟੋਪੀ ਪਾਉਣੀ ਚਾਹੀਦੀ ਹੈ ਅਤੇ ਇੱਕ ਮੋਟਾ ਸਕਾਪ ਵੀ ਜ਼ਰੂਰੀ ਹੁੰਦਾ ਹੈ ਇਸ ਇਸ ਨਾਲ ਸਾਨੂੰ ਬਿਲਕੁਲ ਵੀ ਠੰਢ ਨਹੀਂ ਲੱਗੂਗੀ ਅਤੇ ਸਾਨੂੰ ਆਪਣੀ ਜੇਬ ਵਿੱਚ ਮਾਚਿਸ ਜਾਂ ਲਾਈਟਰ ਵੀ ਰੱਖਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਕਿਤੇ ਵੀ ਅਗਰ ਜ਼ਰੂਰਤ ਪਵੇ ਤਾਂ ਅੱਗ ਲਗਾ ਸਕਣ ਇਸ ਲਈ ਸਾਨੂੰ ਅਤੇ ਕੈਂਪਿੰਗ ਦਾ ਸਮਾਨ ਵੀ ਸਾਨੂੰ ਚਾਹੀਦਾ ਅੱਜ ਕੱਲ੍ਹ ਛੋਟੇ ਮੋਟੇ ਗੈਸ ਵੀ ਆ ਗਏ ਹਨ ਜਿਹੜੇ ਆਪਾਂ ਬੈਗ ਵਿੱਚ ਲੈ ਕੇ ਪਹਾੜਾਂ ਉੱਤੇ ਲੈ ਕੇ ਜਾ ਸਕਦੇ ਹਨ ਸਾਨੂੰ ਉਹ ਵੀ ਲੈ ਕੇ ਜਾਣੇ ਚਾਹੀਦੇ ਹਨ ਅਤੇ ਭੋਜਨ ਖਾਣ ਲਈ ਵੀ ਕਾਫੀ ਸਾਰੀਆਂ ਚੀਜ਼ਾਂ ਲੈ ਕੇ ਜਾਣੀਆਂ ਚਾਹੀਦੀਆਂ ਜਿਵੇਂ ਮੈਗੀ ਹੋਰ ਵੀ ਕਾਫੀ ਪੈਕਜ ਫੂਡ ਆਉਂਦੇ ਹਨ ਅੱਜ ਕੱਲ੍ਹ ਉਹ ਆਪਾਂ ਉੱਪਰ ਬਣਾ ਸਕਦੇ ਹਨ